ਹੈਲੋ ਹੈਲੋ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਛਿਆ ਜੀ ਹਾਂਜੀ ਓਕੇ ਮਤਲਬ ਮੈਮ ਤੁਸੀਂ ਮੇਰੇ ਤੋਂ ਗਾਈਡਨੈਸ ਲੈਣੀ ਹੈ ਵੀ ਕਿੱਥੇ ਘੁੰਮ ਸਕਦੇ ਹਾਂ ਮੈਮ ਉਰੇ ਨਾ ਵੈਸੇ ਸਭ ਤੋਂ ਜ਼ਿਆਦਾ ਵਧੀਆ ਸਾਡੇ ਬਾਜ਼ਾਰ ਬਹੁਤ ਵਧੀਆ ਨੇ ਉਰੇ ਜਿੱਦਾਂ ਕਿ ਸਾਡਾ ਅਦਾਲਤ ਬਜ਼ਾਰ ਹੋ ਗਿਆ ਹੈ ਨਾ ਸ਼ੇਰ ਏ ਮਾਰਕੀਟ ਹੋ ਗਈ ਅਤੇ ਇੱਧਰ ਬੱਸ ਸਟੈਂਡ ਦੇ ਬੈਕ ਸਾਈਡ ਜੁੱਤੀਆਂ ਦਾ ਬਾਜ਼ਾਰ ਬਹੁਤ ਵਧੀਆ ਹੈ ਅਤੇ ਇੱਧਰ ਇੱਕ ਜਿਵੇਂ ਫੇਮਸ ਜੇ ਕੋਲੇਜ ਵਗੈਰਾ ਘੁੰਮਣੇ ਆ ਤਾਂ ਪੰਜਾਬੀ ਯੂਨੀਵਰਸਿਟੀ ਬਹੁਤ ਵਧੀਆ ਇੱਧਰ ਘੁੰਮਣ ਲਈ ਹੈ ਨਾ ਪੰਜਾਬੀ ਯੂਨੀਵਰਸਿਟੀ ਅਤੇ ਥਾਪਰ ਕੋਲਜ ਮਹਿੰਦਰਾ ਕੋਲੇਜ ਬਹੁਤ ਵਧੀਆ ਹੈ ਕਿਉਂਕਿ ਬੱਚੇ ਨੂੰ ਗਾਈਡੈਂਸ ਦੇਣ ਲਈ ਬਹੁਤ ਵਧੀਆ ਕੋਲੇਜ ਹੈ ਉਹ ਅਤੇ ਜਿੱਦਾਂ ਤੁਹਾਡੇ ਨਾਲ ਬੱਚੇ ਬੁੱਚੇ ਹੁੰਦੇ ਆ ਫਿਰ ਇੱਥੇ ਪਾਰਕ ਵੀ ਬਹੁਤ ਵਧੀਆ ਐ ਜਿੱਦਾਂ ਅਰਬਨ ਸਟੇਟ ਫੇਸ ਵਨ ਵਗੈਰਾ 'ਚ ਪਾਰਕ ਆਪਣੇ ਆਪਣੇ ਆਪਣੇ ਆ ਨਾ ਅਤੇ ਉੱਥੇ ਉੱਥੇ ਪਾਰਕ ਬਹੁਤ ਵਧੀਆ ਉੱਥੇ ਝੂਲੇ ਵਗੈਰਾ ਬਹੁਤ ਵਧੀਆ ਅਤੇ ਉੱਥੇ ਤੁਸੀਂ ਬੱਚਿਆਂ ਦਾ ਮਤਲਬ ਫੁੱਲ ਟਾਈਮ ਇੰਜੋਏ ਕਰ ਸਕਦੇ ਹੈ ਬਹੁਤ ਵਧੀਆ ਉੱਥੇ ਜੇ ਤੁਸੀਂ ਰੈਸਟੋਰੈਂਟ ਵਗੈਰਾ ਘੁੰਮਣੇ ਆ ਫਿਰ ਰੈਸਟੋਰੈਂਟ 'ਚ ਜਿਵੇਂ ਆਪਣੇ ਇੱਧਰ ਅ ਗੋਪਾਲ ਸਵੀਟਸ ਹੋ ਗਿਆ ਅਤੇ ਇੱਕ ਇੱਧਰ ਬਾਈ ਨੰਬਰ ਫਾਟਕ 'ਤੇ ਜੱਗੀ ਸਵੀਟਸ ਹੈ ਇੱਧਰ ਜੱਗੀ ਸਵੀਟਸ ਵੀ ਬਹੁਤ ਵਧੀਆ ਖਾਣਾ ਹੁੰਦਾ ਉਹਨਾਂ ਦਾ ਮਤਲਬ ਬਹੁਤ ਸਫ਼ਾਈ ਵੀ ਹੈ ਖੁ ਮੈਂ ਵੀ ਖੁਦ ਬਹੁਤ ਜਾਂਦੀ ਹਾਂ ਉੱਥੇ ਉੱਥੇ ਤਾਂ ਸਫ਼ਾਈ ਬਹੁਤ ਜ਼ਿਆਦਾ ਹੈ ਅਤੇ ਉੱਥੇ ਮਤਲਬ ਖਾਣਾ ਵੀ ਬਹੁਤ ਟੇਸਟੀ ਹੁੰਦਾ ਤੁਸੀਂ ਉੱਥੇ ਵੀ ਜਾ ਕੇ ਵਿਜਿਟ ਕਰ ਸਕਦੇ ਹੋ ਬਹੁਤ ਵਧੀਆ ਉਹ ਹਾਂਜੀ ਕਿਉਂਕਿ ਉਹ ਪਤਾ ਕੀ ਆ ਉੱਥੇ ਨਾ ਮੈਂ ਆਪਣੇ ਬੱਚਿਆ ਨੂੰ ਤਾਂ ਲੈ ਕੇ ਜਾਂਦੀ ਹਾਂ ਕਿਉਂਕਿ ਉੱਥੇ ਸਫ਼ਾਈ ਦਾ ਪ੍ਰਬੰਧ ਬਹੁਤ ਵਧੀਆ ਹੈ ਹਾਂਜੀ ਅਤੇ ਇੱਕ ਇੱਧਰ ਆਪਣੇ ਕਿਲ੍ਹਾ ਹੈ ਮ ਮਹਾਰਾਜਾ ਰਣਜੀਤ ਸਿੰਘ ਦਾ ਕਿਲ੍ਹਾ ਹੈ ਉੱਧਰ ਵੀ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਘੁੰਮ ਸਕਦੇ ਹੋ ਉੱਥੇ ਵੀ ਬਹੁਤ ਵਧੀਆ ਇਤਿਹਾਸਿਕ ਚੀਜ਼ਾਂ ਦੇਖਣ ਨੂੰ ਬਹੁਤ ਵਧੀਆ ਨੇ ਉੱਥੇ ਨਹੀਂ ਮੈਮ ਅਗਰ ਬੱਚੇ ਹੋਣ ਤਾਂ ਥੋੜ੍ਹਾ ਕੁ ਦੇਖੋ ਬੱਚੇ ਥੋੜ੍ਹਾ ਜਿੱਦ ਲੱਗ ਜਾਂਦੇ ਆ ਕਰਨ ਹੈ ਨਾ ਟਾਈਮ ਲੱਗ ਜਾਂਦਾ ਹੈ ਪਰ ਜੇ ਆਪਾਂ ਪੂਰੀ ਫੈਮਲੀ ਉੱਤੇ ਵੱਡੇ ਹੋਣ ਉਹ ਥੋੜ੍ਹਾ ਘੱਟ ਟਾਈਮ ਲੱਗਦਾ ਐ ਕਿਉਂਕੀ ਫੈਮਲੀ ਤੁਹਾਨੂੰ ਪਤਾ ਅੱਗੇ ਅੱਗੇ ਦੇਖੀ ਜਾਂਦੀ ਆ ਪਰ ਬੱਚਿਆਂ ਕਰਕੇ ਥੋੜ੍ਹਾ ਜਿਹਾ ਟਾਈਮ ਲੱਗ ਜਾਂਦਾ ਹੈ ਹਾਂਜੀ ਬਹੁਤ ਵਧੀਆ ਤੁਸੀਂ ਬਹੁਤ ਵਧੀਆ ਇੰਜੋਏ ਕਰੋਂਗੇ ਵਿਜ਼ਿਟ ਕਰੋ ਆਪਦਾ ਨਹੀਂ ਨਹੀਂ ਕੋਈ ਗੱਲ ਨਹੀਂ ਮੈਮ ਅਗਰ ਕੋਈ ਲੋੜ ਪਈ ਤਾਂ ਫਿਰ ਫੋਨ ਕਰਿਓ ਓਕੇ ਜੀ ਥੈਂਕ ਯੂ